ਪੰਜਾਬੀ ਭਾਸ਼ਾ ਨੂੰ ਭਵਿੱਖ ਦੇ ਵਿੱਚ ਬਹੁਤ ਵਧੀਆ ਬਣ ਵਧਾਇਆ ਜਾ ਸਕਦਾ ਹੈ ਇਸ ਦੇ ਲਈ ਸਾਨੂੰ ਕੁਝ ਉਪਰਾਲੇ ਕਰਨੇ ਪੈਣੇ ਨੇ ਜਿਵੇਂ ਕਿ ਅਸੀਂ ਪੰਜਾਬੀ ਜਿਹੜੀ ਆ ਉਹ ਦਫਤਰਾਂ ਦੇ ਵਿੱਚ ਵੱਧ ਤੋਂ ਵੱਧ ਵਰਤੀ ਜਾਵੇ ਸ ਅਤੇ ਆਪਣੇ ਜਿਹੜੇ ਉੱਥੇ ਦੇ ਕਰਮਚਾਰੀ ਨੇ ਉਹਨਾਂ ਨੂੰ ਸਿਖਾਇਆ ਜਾਵੇ ਪੰਜਾਬੀ ਸਿਖਾਈ ਜਾਵੇ ਅਤੇ ਸਕੂਲਾਂ ਦੇ ਵਿੱਚ ਇੱਕ ਮੁੱਖ ਵਿਸ਼ਾ ਪੰਜਾਬੀ ਦਾ ਦਿੱਤਾ ਜਾਵੇ ਤਾਂ ਕਿ ਜੋ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਬੋਲਣ ਅਤੇ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਵੇ